ਹੈਲੋ ਸਤਿ ਸ਼੍ਰੀ ਅਕਾਲ ਜੀ ਗੁਰੂ ਕਿਰਪਾ ਟਰੈਵਲ ਏਜੰਸੀ ਤੋਂ ਬੋਲ ਰਹੇ ਜੀ ਮੈਂ ਨਾ ਔਨਲਾਈਨ ਕੈਬ ਬੁੱਕ ਕਰਵਾਈ ਸੀਗੀ ਡਰਾਈਵਰ ਸੁਖਰਾਜ ਸਿੰਘ ਆ ਅਤੇ ਮੈਂ ਅਤੇ ਮੇਰੇ ਪਰਿਵਾਰ ਨੇ ਅੱਜ ਜਾਣਾ ਸੀਗਾ ਸੈਰ ਸਪਾਟੇ ਲਈ ਅਤੇ ਲੰਬੇ ਸਮੇਂ ਤੋਂ ਮੈਂ ਉਹਨਾਂ ਨੂੰ ਫੋਨ ਲਾ ਰਿਹਾ ਸੰਪਰਕ ਕਰ ਰਿਹਾ ਉਹਨਾਂ ਦਾ ਫੋਨ ਵੀ ਨਹੀਂ ਲੱਗ ਰਿਹਾ ਦੇਖੋ ਸਮਾਂ ਸਾਰਿਆਂ ਲਈ ਬੜਾ ਕੀਮਤੀ ਹੁੰਦਾ ਵਾ ਸਾਡੇ ਲਈ ਵੀ ਕੀਮਤੀ ਮੈਂ ਛੁੱਟੀ ਵੀ ਕੀਤੀ ਆਪਣੇ ਕੰਮ ਤੋਂ ਪਰਿਵਾਰ ਵੀ ਸਾਰਾ ਸਾਡਾ ਸਾਰਿਆਂ ਕੰਮ ਛੱਡ ਕੇ ਖੜ੍ਹੇ ਆ ਵੇਟ ਕਰ ਰਿਹਾ ਇੰਤਜ਼ਾਰ ਕਰ ਰਿਹਾ ਲੰਬਾ ਸਮਾਂ ਹੋ ਗਿਆ ਇਵੇਂ ਗੱਲ ਚੰਗੀ ਨਹੀਂ ਲੱਗਦੀ ਸਮਾਂ ਸਾਰਿਆਂ ਲਈ ਕੀਮਤੀ ਆ ਸਮੇਂ ਦੀ ਕਦਰ ਕਰਨਾ ਸਾਡਾ ਪਹਿਲਾ ਜਿਹੜਾ ਇੱਕ ਫਰਜ਼ ਬਣਦਾ ਇਸ ਕਰਕੇ ਸਾਡਾ ਸਾਡੇ ਪਰਿਵਾਰ ਦਾ ਕਿੰਨਾ ਸਮਾਂ ਖ਼ਰਾਬ ਹੋਇਆ ਅਤੇ ਅਸੀਂ ਵਾਰ ਵਾਰ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਸੰਪਰਕ ਕੀਤਾ ਜਾਵੇ ਪਰ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਨਾਲ ਸੰਪਰਕ ਨਹੀਂ ਹੋ ਰਿਹਾ ਸੋ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਆ ਇਸੇ ਲਈ ਮੈਂ ਉਹਨਾਂ ਦੀ ਸ਼ਿਕਾਇਤ ਕਰਨ ਦੇ ਲਈ ਤੁਹਾਡੇ ਨਾਲ ਸੰਪਰਕ ਕੀਤਾ ਤੁਸੀਂ ਉਹਦੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਕਿਉਂਕਿ ਇਵੇਂ ਅਗਾਂਹ ਤੋਂ ਅਸੀਂ ਫਿਰ ਕਦੇ ਵੀ ਤੁਹਾਡੀ ਟਰੈਵਲ ਏਜੰਸੀ ਤੋਂ ਕੈਬ ਬੁੱਕ ਨਹੀਂ ਕਰਾਵਾਂਗੇ ਜਿਹੜੀਆਂ ਮੁਸ਼ਕਿਲਾਂ ਦਾ ਸਾਨੂੰ ਅੱਜ ਸਾਹਮਣਾ ਕਰਨਾ ਪੈ ਰਿਹਾ ਇਹ ਫਿਰ ਮੁਸ਼ਕਿਲਾਂ ਔਖੀਆਂ ਲੱਗਦੀਆਂ ਨੇ ਸਮਾਂ ਬੜਾ ਕੀਮਤੀ ਆ ਅਸੀਂ ਆਪਣਾ ਸਾਰਾ ਸਮਾਂ ਛੱਡ ਕੇ ਛੁੱਟੀ ਵੀ ਲਈ ਹੈ ਛੁੱਟੀ ਵੀ ਖ਼ਰਾਬ ਕੀਤੀ ਆ ਅਸੀਂ ਜਾਣਾ ਸੀਗਾ ਪਰਿਵਾਰ ਸਮੇਤ ਜ਼ਰੂਰੀ ਕਾਰਜ ਸੀਗੇ ਜਿਹਦੇ ਕਰਕੇ ਅਸੀਂ ਉਹਨਾਂ ਤੋਂ ਕੈਬ ਬੁੱਕ ਕਰਵਾਈ ਸੀਗੀ ਪਰ ਇਵੇਂ ਸਹੀ ਨਹੀਂ ਲੱਗਦਾ ਸੋ ਆਪ ਜੀ ਨੇ ਕਿਰਪਾ ਕਰਕੇ ਇੱਧਰ ਇਸ ਗੱਲ ਵੱਲ ਧਿਆਨ ਦੇਣਾ